ਮੇਰੇ ਵਿੱਚ ਬਹੁਤ ਸਾਰੀਆਂ ਕਲਾਵਾਂ ਹਨ ਅਤੇ ਮੈਂ ਹਰ ਕਲਾ ਦਾ ਸਨਮਾਨ ਕਰਦੀ ਹਾਂ ਮੇਰੀ ਮੁੱਖ ਕਲਾ ਸੰਗੀਤ ਹੈ ਜਦੋਂ ਮੇਰੇ ਕੋਲ ਵਿਹਲਾ ਸਮਾਂ ਹੁੰਦਾ ਹੈ ਮੈਂ ਗਾਣੇ ਸੁਣਦੀ ਹਾਂ ਅਤੇ ਗਾਣੇ ਬੋਲਦੀ ਵੀ ਹਾਂ ਜ਼ਿਆਦਾਤਰ ਗਾਣੇ ਮੈਂ ਪੰਜਾਬੀ ਵਿੱਚ ਪਸੰਦ ਕਰਦੀ ਹਾਂ ਪਰ ਕਈ ਵਾਰ ਕੁਛ ਹਿੰਦੀ ਸੰਗੀਤ ਵੀ ਅਜਿਹੇ ਹੁੰਦੇ ਹੈ ਜਿਹਦੇ ਨਾਲ ਅਸੀਂ ਮੋਹਿਤ ਹੋ ਜਾਂਦੇ ਹਾਂ ਮੈਨੂੰ ਹਿੰਦੀ ਅਤੇ ਪੰਜਾਬੀ ਸੰਗੀਤ ਬਹੁਤ ਪਸੰਦ ਹੈ ਮੈਂ ਵੱਖ ਵੱਖ ਸ਼ੈਲੀਆਂ ਵਿੱਚ ਗੀਤ ਗਾਉਣੇ ਪਸੰਦ ਕਰਦੀ ਹਾਂ ਅਤੇ ਕਈ ਵਾਰੀ ਸੁਣਦੀ ਵੀ ਹਾਂ ਹਿੰਦੀ ਅਤੇ ਪੰਜਾਬੀ ਮੇਰੀ ਮੁੱਖ ਗਾਇਕੀ ਹੈ ਜੋ ਵੋਕਲ ਸ਼ੈਲੀਆਂ ਰਾਹੀ ਮੈਂ ਇਹਨਾਂ ਦੇ ਸੰਗੀਤ ਦਾ ਆਨੰਦ ਲੈਂਦੀ ਹਾਂ ਕਈ ਵਾਰ ਵਿਹਲੇ ਸਮੇਂ ਵਿੱਚ ਜਦੋਂ ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ ਮੈਂ ਆਪਣੇ ਘਰ ਦੇ ਵਿੱਚ ਹੀ ਸੰਗੀਤ ਲਗਾ ਕੇ ਅਭਿਆਸ ਕਰਦੀ ਹਾਂ ਤਾਂ ਕਿ ਵੱਖ ਵੱਖ ਤਰ੍ਹਾਂ ਦੀਆਂ ਸੰਗੀਤ ਦੀਆਂ ਇਹ ਸ਼ੈਲੀਆਂ ਨੂੰ ਸੁਣ ਸਕਾਂ ਅਤੇ ਬੋਲ ਸਕਾਂ ਕਈ ਵਾਰ ਇਕੱਲੇ ਵਿੱਚ ਬੈਠੇ ਮੈਂ ਉਦਾਸੀ ਵਾਲੇ ਗੀਤ ਵੀ ਸੁਣਦੀ ਹਾਂ ਕਿਉਂਕਿ ਮੈਨੂੰ ਉਦਾਸੀ ਗੀਤ ਅਤੇ ਪਿਆਰ ਵਾਲੇ ਸੰਗੀਤ ਬਹੁਤ ਪਸੰਦ ਹੈ ਇਸ ਕਰਕੇ ਮੈਂ ਵੱਧ ਤੋਂ ਵੱਧ ਸਮਾਂ ਗਾਇਕੀ ਵਿੱਚ ਲੰਘਾਉਂਦੀ ਹਾਂ ਤਾਂ ਕਿ ਉਹਦੇ ਨਾਲ ਮੇਰਾ ਮਨੋਰੰਜਨ ਵੀ ਹੋ ਸਕੇ ਅਤੇ ਮੈਂ ਗਾਣੇ ਸੁਣ ਕੇ ਉਹਦਾ ਅਭਿਆਸ ਕਰਾਂ ਅਤੇ ਉਸਨੂੰ ਆਪਣੇ ਜੀਵਨ ਦੇ ਵਿੱਚ ਸ਼ਾਮਿਲ ਵੀ ਕਰ ਸਕਾਂ ਹਿੰਦੀ ਅਤੇ ਪੰਜਾਬੀ ਗਾਣੇ ਸੁਣਨਾ ਮੈਨੂੰ ਬਹੁਤ ਹੀ ਪਸੰਦਾ ਹੈ